ਪਿਛਲੇ ਸਮੇਂ ਵਿੱਚ ਕਢਾਈ ਅਲਗ ਤਰੀਕੇ ਨਾਲ ਕੀਤੀ ਜਾਂਦੀ ਸੀ ਅਤੇ ਅੱਜ ਦੇ ਸਮੇਂ ਵਿੱਚ ਕਢਾਈ ਅਲੱਗ ਤਰੀਕੇ ਨਾਲ ਕੀਤੀ ਜਾਂਦੀ ਹੈ ਪਿਛਲੇ ਸਮੇਂ ਵਿੱਚ ਕਢਾਈ ਕਰਨ ਵਾਸਤੇ ਕੋਈ ਖਾਸ ਮਸ਼ੀਨਾਂ ਦਾ ਉਪਯੋਗ ਨਹੀਂ ਕੀਤਾ ਜਾਂਦਾ ਸੀ ਹੱਥ ਨਾਲ ਹੀ ਕਢਾਈ ਕੀਤੀ ਜਾਂਦੀ ਸੀ ਸੂਈ ਧਾਗਾ ਲੈ ਕੇ ਉਹਦੇ ਤੇ ਕਢਾਈ ਕੀਤੀ ਜਾਂਦੀ ਸੀ ਕੱਪੜੇ ਦੇ ਉੱਤੇ ਹੁਣ ਕੱਪੜੇ ਦਾ ਕਢਾਈ ਕਰਨ ਦੇ ਉੱਤੇ ਕੱਪੜੇ ਵਾਸਤੇ ਕਢਾਈ ਕਰਨ ਲਈ ਬਹੁਤ ਸਾਰੀਆਂ ਮਸ਼ੀਨਾਂ ਉਪਲਬਧ ਹਨ ਲੋਕ ਅਲੱਗ ਅਲੱਗ ਮਸ਼ੀਨਾਂ ਦਾ ਇਸਤੇਮਾਲ ਕਰਕੇ ਕਢਾਈ ਕੱਢਦੇ ਹਨ ਪਹਿਲੇ ਕਢਾਈ ਬਹੁਤ ਹੀ ਸੋਹਣੀ ਅਤੇ ਹੱਥ ਨਾਲ ਕੀਤੀ ਹੋਈ ਹੁੰਦੀ ਸੀ ਹੁਣ ਕਢਾਈ ਮਸ਼ੀਨਾਂ ਦੁਆਰਾ ਕੀਤੀ ਜਾਂਦੀ ਹੈ ਪਹਿਲੇ ਕਢਾਈ ਥੋੜ੍ਹੀ ਵਿਰਲੀ ਵਿਰਲੀ ਹੁੰਦੀ ਸੀ ਹੁਣ ਕਢਾਈ ਬਹੁਤ ਜ਼ਿਆਦਾ ਸੰਘਣੀ ਹੁੰਦੀ ਹੈ ਕਿਉਂਕਿ ਉਹਦੇ 'ਤੇ ਮਸ਼ੀਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਅੱਜ ਦੇ ਜਿੱਦਾਂ ਜਿੱਦਾਂ ਅੱਜ ਦੇ ਯੁੱਗ ਦੇ ਵਿੱਚ ਪਰਿਵਰਤਨ ਆ ਰਿਹਾ ਹੈ ਕਢਾਈ ਦੇ ਵਿੱਚ ਵੀ ਬਹੁਤ ਪਰਿਵਰਤਨ ਦਿਖਾਈ ਦੇ ਰਿਹਾ ਹੈ ਲੋਕ ਅੱਜ ਕੱਲ੍ਹ ਦੀ ਕਢਾਈ ਨੂੰ ਪਸੰਦ ਕਰਦੇ ਹਨ ਪੁਰਾਣੀ ਕਢਾਈ ਨੂੰ ਵੀ ਪਸੰਦ ਕਰਦੇ ਹਨ ਪੁਰਾਣੀ ਕਢਾਈ ਦੇਖਣ 'ਚ ਬਹੁਤ ਸੋਹਣੀ ਲੱਗਦੀ ਹੈ ਲੇਕਿਨ ਅੱਜ ਦੀ ਕਢਾਈ ਦਾ ਕੰਮ ਬਹੁਤ ਹੀ ਬਾਰੀਕ ਹੁੰਦਾ ਹੈ ਮਹੀਨ ਕਢਾਈ ਕੀਤੀ ਜਾਂਦੀ ਹੈ ਇਸ ਕਰਕੇ ਲੋਕ ਅੱਜ ਦੀ ਕਢਾਈ ਨੂੰ ਜ਼ਿਆਦਾ ਪਸੰਦ ਕਰਦੇ ਹਨ ਪਿਛਲੀ ਕਢਾਈਆਂ ਬਹੁਤ ਹੀ ਜ਼ਿਆਦਾ ਵਧੀਆ ਅਤੇ ਬਹੁਤ ਹੀ ਦੇਰ ਉਹਨਾਂ ਦੇ ਉਹਨਾਂ ਦੇ ਵਿੱਚ ਇਸਤੇਮਾਲ ਕੀਤੇ ਗਏ ਜਿਹੜੇ ਧਾਗੇ ਹਨ ਬਹੁਤ ਹੀ ਜ਼ਿਆਦਾ ਦੇਰ ਝੱਲਣ ਵਾਲੇ ਹਨ ਧੰਨਵਾਦ